ਹਾਂ ਅੱਜ ਦੇ ਭਾਰਤ ਵਿੱਚ ਵੱਖ ਵੱਖ ਤਰ੍ਹਾਂ ਦੇ ਬੀਮਾ ਵਿਕਲਪ ਉਪਲਭਧ ਹਨ ਜਿਵੇਂ ਕਿ ਹੈਲਥ ਇਨਸ਼ੋਰੈਂਸ ਟਰਮ ਇਨਸ਼ੋਰੈਂਸ ਲਾਈਫ ਇਨਸ਼ੋਰੈਂਸ ਮੇਰੇ ਖਿਆਲ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬਿਮਾ ਕਰਵਾਉਣ ਦਾ ਅਲੱਗ ਅਲੱਗ ਹੀ ਫਾਇਦਾ ਜਿਵੇਂ ਕਿ ਜ਼ਿੰਦਗੀ ਦਾ ਬੀਮਾ ਕਰਵਾਉਣ ਨਾਲ ਜਿੰਦਗੀ ਦਾ ਕਵਰ ਤਿਆਰ ਹੁੰਦਾ ਹੈ ਤੇ ਟਰਮ ਇਨਸ਼ੋਰੈਂਸ ਕਰਾਉਣ ਨਾਲ ਟਰਮ ਲਾਈਫ ਦਾ ਕਵਰ ਠੀਕ ਹੁੰਦਾ ਹੈ ਹੈਲਥ ਇੰਸ਼ੋਰੈਂਸ ਕਰਾਉਣ ਨਾਲ ਹੈਲਥ ਇੰਸ਼ੋਰੈਂਸ ਕਰਵਾਉਣ ਨਾਲ ਹੈਲਥ ਦਾ ਕਵਰ ਹੁੰਦਾ ਹੈ ਜੀਵਨ ਬੀਮਾ ਕਰਵਾਉਣਾ ਹਰ ਇੱਕ ਲਈ ਬਹੁਤ ਜਰੂਰੀ ਹੈ ਟਰਮ ਇਨਸ਼ੋਰੈਂਸ ਤੁਸੀਂ ਇਕ ਕਰੋੜ ਪੰਜਾਹ ਲੱਖ ਪੱਚੀ ਲੱਖ ਦਾ ਕਰਵਾ ਸਕਦੇ ਹੋ ਹੈਲਥ ਇਨਸ਼ੋਰੈਂਸ ਪੰਜ ਲੱਖ ਦਾ ਦਸ ਲੱਖ ਪੰਦਰਾਂ ਲੱਖ ਦਾ ਵੀਹ ਲੱਖ ਦਾ ਕਰਵਾ ਲਾਈਫ ਦਾ ਪੰਜਾਹ ਲੱਖ ਦਾ ਪੱਚੀ ਲੱਖ ਦਾ ਪਚੱਤਰ ਲੱਖ ਦਾ ਇਕ ਕਰੋੜ ਦਾ ਕਰਵਾ ਸਕਦਾ ਇਹ ਸਾਰੇ ਤੁਹਾਨੂੰ ਜਦੋਂ ਪੋਲਸੀ ਕਵਰ ਖਤਮ ਹੁੰਦਾ ਉਸ ਤੋਂ ਬਾਅਦ ਮਿਲ ਜਾਂਦੇ ਹਨ ਟਰਮ ਇਨਸ਼ੋਰੈਂਸ ਵਿੱਚ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਮਿਲੇਗਾ ਅਗਰ ਤੁਹਾਡੀ ਕਿਸੇ ਵੀ ਤਰ੍ਹਾਂ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਹੈ ਇਹ ਫਾਇਦਾ ਤੁਹਾਡੇ ਪਰਿਵਾਰ ਨੂੰ ਮਿਲੇਗਾ ਹੈਲਥ ਇੰਸ਼ੋਰੈਂਸ ਵਿੱਚ ਤੁਹਾਨੂੰ ਕੈਸ਼ਲੈਸ ਬੀਮਾ ਮਿਲੇਗਾ